ਸਮੇਂ ਦਾ ਦੇ ਨਾਲ ਮੇਰਾ ਯੋਗ ਦਾ ਅਭਿਆਸ ਇੱਕ ਲੰਮੀ ਯਾਤਰਾ ਦੀ ਤਰ੍ਹਾਂ ਰਿਹਾ ਹੈ ਜਿਸ ਵਿੱਚ ਬਹੁਤ ਸਾਰੇ ਮੋੜ ਅਤੇ ਬਦਲਾਅ ਆਏ ਹਨ ਜਦੋਂ ਮੈਂ ਪਹਿਲੀ ਵਾਰ ਯੋਗ ਸ਼ੁਰੂ ਕੀਤਾ ਤਾਂ ਮੇਰੀ ਸੋਚ ਬਹੁਤ ਸੌਖੀ ਸੀ ਮੈਂ ਸਿਰਫ ਸਰੀਰਕ ਲਾਭਾਂ 'ਤੇ ਧਿਆਨ ਕੇਂਦਰਿਤ ਕਰਦਾ ਸੀ ਜਿਵੇਂ ਕਿ ਲਚਕਤਾ ਵਧਾਉਣਾ ਤਾਕਤ ਪੈਦਾ ਕਰਨਾ ਅਤੇ ਸਰੀਰ ਨੂੰ ਫਿਟ ਰੱਖਣਾ ਮੈਨੂੰ ਲੱਗਦਾ ਸੀ ਕਿ ਯੋਗ ਸਿਰਫ ਇੱਕ ਕਿਸਮ ਦੀ ਕਸਰਤ ਹੈ ਜਿਸ ਨੂੰ ਸਖਤ ਆਸਣਾਂ ਨਾਲ ਕੀਤਾ ਜਾਂਦਾ ਹੈ ਪਰ ਜਿਵੇਂ ਜਿਵੇਂ ਮੈਂ ਯੋਗ ਕਰਨਾ ਜਾਰੀ ਰੱਖਿਆ ਮੈਂ ਮਹਿਸੂਸ ਕੀਤਾ ਕਿ ਇਹ ਸਿਰਫ ਸਰੀਰਕ ਗਤੀਵਿਧੀਆਂ ਤੋਂ ਕਿਤੇ ਵੀ ਵੱਧ ਹੈ ਮੈਂ ਸਮਝਿਆ ਕਿ ਯੋਗ ਮੇਰੇ ਮਨ ਅਤੇ ਆਤਮਾ ਨੂੰ ਵੀ ਸ਼ਾਂਤ ਕਰਦਾ ਹੈ ਇਹ ਮੈਨੂੰ ਆਪਣੇ ਅੰਦਰਲੇ ਸਵੈ ਨਾਲ ਜੁੜਨ ਵਿੱਚ ਮਦਦ ਕਰਦਾ ਹੈ ਅਤੇ ਮੈਨੂੰ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਬਾਰੇ ਵਧੇਰੇ ਜਾਗਰੂਕ ਬਣਾਉਂਦਾ ਹੈ ਸ਼ੁਰੂ ਵਿੱਚ ਮੈਂ ਹਰ ਆਸਣ ਨੂੰ ਸਹੀ ਢੰਗ ਨਾਲ ਕਰਨ ਦੀ ਕੋਸ਼ਿਸ਼ ਕਰਦਾ ਸੀ ਅਤੇ ਜੇ ਮੈਂ ਕਿਸੇ ਆਸਣ ਵਿੱਚ ਮੁਸ਼ਕਿਲ ਮਹਿਸੂਸ ਕਰਦਾ ਸੀ ਤਾਂ ਮੈਂ ਆਪਣੇ ਆਪ ਨੂੰ ਨਿਰਾਸ਼ ਮਹਿਸੂਸ ਕਰਦਾ ਸੀ ਪਰ ਹੌਲੀ ਹੌਲੀ ਮੈਂ ਸਿੱਖਿਆ ਕਿ ਯੋਗ ਮੁਕਾਬਲੇ ਬਾਰੇ ਨਹੀਂ ਹੈ ਸਗੋਂ ਆਪਣੇ ਆਪ ਨਾਲ ਜੁੜਨ ਅਤੇ ਆਪਣੇ ਸਰੀਰ ਨੂੰ ਸੁਣਨ ਬਾਰੇ ਹੈ ਮੈਂ ਸਿੱਖਿਆ ਕਿ ਹਰ ਵਿਅਕਤੀ ਦਾ ਸਰੀਰ ਵੱਖਰਾ ਹੁੰਦਾ ਹੈ ਅਤੇ ਮੈਨੂੰ ਆਪਣੇ ਸਰੀਰ ਦੀਆਂ ਸੀਮਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਮੇਰੇ ਯੋਗ ਅਭਿਆਸ ਵਿੱਚ ਸਭ ਤੋਂ ਵੱਡਾ ਬਦਲਾਅ ਸਾਹ ਲੈਣ ਦੀ ਤਕਨੀਕ ਅਤੇ ਧਿਆਨ ਦੇ ਮਹੱਤਵ ਨੂੰ ਸਮਝਣਾ ਸੀ ਮੈਂ ਸਿੱਖਿਆ ਕਿ ਕਿਵੇਂ ਆਪਣੇ ਸਾਹ ਨੂੰ ਨਿਯੰਤਰਿਤ ਕਰਨਾ ਹੈ ਅਤੇ ਕਿਵੇਂ ਆਪਣੇ ਮਨ ਨੂੰ ਸ਼ਾਂਤ ਕਰਨਾ ਹੈ ਇਹ ਤਕਨੀਕਾਂ ਮੈਨੂੰ ਤਣਾਅ ਅਤੇ ਚਿੰਤਾ ਤੋਂ ਮੁਕਤ ਕਰਨ ਵਿੱਚ ਮਦਦ ਕਰਦੀਆਂ ਹਨ ਅਤੇ ਮੈਨੂੰ ਵਰਤਮਾਨ ਵੱਲ ਵਿੱਚ ਰਹਿਣ ਵਿੱਚ ਮਦਦ ਕਰਦੀਆਂ ਹਨ ਸਮੇਂ ਦੇ ਨਾਲ ਮੇਰਾ ਯੋਗ ਦਾ ਅਭਿਆਸ ਵਧੇਰੇ ਨਰਮ ਅਤੇ ਧਿਆਨ ਕੇਂਦਰਿਤ ਹੋ ਗਿਆ ਹੈ ਮੈਂ ਹੁਣ ਸਖਤ ਆਸਣਾਂ ਦੀ ਬਜਾਏ ਹੋਲੀ ਅਤੇ ਸਾਵਧਾਨ ਆਸਣ ਕਰਦਾ ਹਾਂ ਮੈਂ ਹਰ ਆਸਣ ਵਿੱਚ ਆਪਣੇ ਸਾਹਾਂ ਅਤੇ ਸਰੀਰ ਦੀਆਂ ਭਾਵਨਾਵਾਂ ਦੇ ਧਿਆਨ ਕੇਂਦਰਿਤ ਕਰਦਾ ਹਾਂ ਮੈਂ ਯੋਗ ਨੂੰ ਆਪਣੇ ਜੀਵਨ ਦਾ ਇੱਕ ਅਨਿੱਖੜਾ ਅੰਗ ਬਣਾ ਲਿਆ ਹੈ ਮੈਂ ਹਰ ਰੋਜ਼ ਯੋਗ ਕਰਦਾ ਹਾਂ ਭਾਵੇਂ ਮੇਰੇ ਕੋਲ ਸਿਰਫ ਕੁਝ ਮਿੰਟ ਹੀ ਕਿਉਂ ਨਾ ਹੋਣ